ਮੇਰੀ ਮਨਪਸੰਦ ਬਾਈਕ ਸਪਲੈਂਡਰ ਬੁਲਟ ਪਲਸਰ ਆਰ ਵੰਨ ਫਾਈਵ ਕੇਟੀਐੱਮ ਕੇਟੀਐੱਮ ਹੈ ਅਤੇ ਮੇਰੇ ਮੇਰੇ ਕੋਲ ਸਪਲੈਂਡਰ ਬਾਈਕ ਹੈ ਅਤੇ ਮੇਰੀ ਡਰੀਮ ਬਾਈਕ ਕ ਕੇਟੀਐੱਮ ਟੂ ਟੂ ਟਵੰਟੀ ਹੈ ਜੋ ਕਿ ਬਹੁਤ ਜ਼ਿਆਦਾ ਹੀ ਵਧੀਆ ਕੰਫਰਟੇਬਲ ਬਾਈਕ ਹੈ ਜ ਕੋਈ ਵੀ ਬਾਈਕ ਹੈ ਜਿਵੇਂ ਕਿ ਆਪਾਂ ਯਾਤਰਾਵਾਂ 'ਤੇ ਜਾਂਦੇ ਹਾਂ ਲੋਂਗ ਰੂਟ 'ਤੇ ਜਾਂਦੇ ਹਾਂ ਘੁੰਮਣ ਲਈ ਜਾਂਦੇ ਹਾਂ ਤਾਂ ਸਭ ਤੋਂ ਜ਼ਿਆਦਾ ਕੰਫਰਟੇਬਲ ਬੈ ਬਾਈਕ ਹੁੰਦੀ ਹੈ ਪਲਸਰ ਕੇਟੀਐੱਮ ਆਰ ਵੰਨ ਫਾਈਵ ਜੋ ਕਿ ਸਭ ਤੋਂ ਜ਼ਿਆਦਾ ਵਧੀਆ ਔਰ ਆਰਾਮਦਾਇਕ ਹੁੰਦੀ ਹੈ ਸਭ ਤੋਂ ਜ਼ਿਆਦਾ ਕੰਫਰਟੇਬਲ ਹੁੰਦੀ ਹੈ ਸਭ ਤੋਂ ਬਹੁਤ ਜ਼ਿਆਦਾ ਵਧੀਆ ਬਾਈਕ ਨੇ ਤਾਂ ਮੇਰਾ ਵੀ ਇਹ ਡਰੀਮ ਹੈ ਕਿ ਮੈਂ ਵੀ ਆਰ ਵੰਨ ਫਾਈਵ ਅਤੇ ਕੇਟੀਐੱਮ ਹੀ ਲੈਣੀ ਹੈ ਇਸ ਟਾਈਮ ਮੇਰੇ ਕੋਲ ਸਪਲੈਂਡਰ ਹੈ ਤਾਂ ਉਸ 'ਤੇ ਵੀ ਬਹੁਤ ਆਰਾਮਦਾਇਕ ਹੁੰਦਾ ਹੈ ਬਹੁਤ ਜ਼ਿਆਦਾ ਘੁੰਮਣਾ ਬਾਈਕਿੰਗ ਕਰਨੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਹੀ ਹੋਰ ਵੀ ਬਹੁਤ ਮਾਰਕਿਟ ਦੇ ਵਿੱਚ ਬਾਈਕ ਨੇ ਲੇਕਿਨ ਇਹ ਸਭ ਤੋਂ ਜ਼ਿਆਦਾ ਵਧੀਆ ਬਾਈਕ ਇਹ ਇਹੀ ਨੇ